ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਹਰਪ੍ਰੀਤ ਸਿੰਘ ਗੱਲ ਕਰ ਰਿਹਾ ਨਵਾਂਸ਼ਹਿਰ ਤੋਂ ਤੁਸੀਂ ਦਸ਼ਮੇਸ਼ ਢਾਬੇ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਸਰ ਮੈਂ ਪਿਛਲੇ ਹਫ਼ਤੇ ਇੱਧਰ ਵਿਜਿਟ ਕੀਤਾ ਸੀ ਤੁਹਾਡੇ ਢਾਬੇ 'ਤੇ ਖਾਣਾ ਖਾ ਕੇ ਗਿਆ ਸੀ ਬੜਾ ਅੱਛਾ ਲੱਗਿਆ ਅਤੇ ਹੁਣ ਮੇਰੇ ਘਰ ਗੈਸਟ ਆ ਰਹੇ ਨੇ ਜੀ ਉਹਨਾਂ ਦੇ ਲਈ ਪੰਜ ਬੰਦਿਆਂ ਲਈ ਖਾਣੇ ਦੀ ਜ਼ਰੂਰਤ ਹੈ ਇਹਦੇ ਵਿੱਚ ਤੁਸੀਂ ਮਟਰ ਪਨੀਰ ਸ਼ਾਹੀ ਪਨੀਰ ਮਿਕਸ ਵੈੱਜ ਅਤੇ ਮਲਾਈ ਕੋਫਤਾ ਅਤੇ ਹੋਰ ਕੁਝ ਸਲਾ ਸੈਲਡ ਭੇਜ ਦਿਉ ਬੜਾ ਅੱਛਾ ਖਾਣਾ ਸੀ ਮੈਂ ਚਾਹੁੰਦਾ ਕਿ ਜਿਹੜੇ ਮੇਰੇ ਗੈਸਟ ਆ ਰਹੇ ਨੇ ਘਰ ਮੈਂ ਉਹਨਾਂ ਨੂੰ ਤੁਹਾਡੇ ਢਾਬੇ ਦਾ ਸਵਾਦ ਚੱਖਾਵਾਂ ਅਤੇ ਕਿਰਪਾ ਕਰਕੇ ਥੋੜ੍ਹਾ ਔਡਰ ਜਲਦੀ ਭੇਜ ਦਿਉ ਜੀ ਤੁਹਾਡੇ ਢਾਬੇ ਦਾ ਖਾਣਾ ਬਹੁਤ ਅੱਛਾ ਹੈ ਜੀ ਮੈਂ ਚਾਹੁੰਦਾ ਵੀ ਜਿਹੜੇ ਮੇਰੇ ਗੈਸਟ ਆੲ ਆਏ ਨੇ ਉਹਨਾਂ ਨੂੰ ਵੀ ਤੁਹਾਡੇ ਢਾਬੇ ਦਾ ਖਾਣੇ ਦਾ ਸਵਾਦ ਚੱਖਾਇਆ ਜਾਵੇ